ਸਰਕਾਰੀ ਨੌਕਰੀ ਅਤੇ ਆਪਣੇ ਕਾਰੋਬਾਰ ਵਿੱਚ ਬਹੁਤ ਫਰਕ ਹੁੰਦਾ ਸਰਕਾਰੀ ਨੌਕਰੀ ਦਾ ਮਤਲਬ ਸਰਕਾਰ ਦੇ ਨੌਕਰ ਆਪਣਾ ਕਾਰੋਬਾਰ ਮਤਲਬ ਅਸੀਂ ਆਪਣੀ ਜ਼ਿੰਦਗੀ ਦੇ ਆਪ ਮਾਲਕ ਹਾਂ ਜਿੰਨਾ ਮਰਜ਼ੀ ਕਮਾਈਏ ਜਦੋਂ ਮਰਜ਼ੀ ਛੁੱਟੀ ਕਰੀਏ ਮੈਂ ਦੋਵਾਂ ਵਿੱਚੋਂ ਕਾਰੋਬਾਰ ਨੂੰ ਹੀ ਚੁਣਾਂਗੀ ਮੈਂ ਕੁਝ ਕੁ ਸਾਲ ਸਕੂਲ 'ਚ ਨੌਕਰੀ ਕੀਤੀ ਉੱਥੇ ਰਹਿਣ ਸਹਿਣ ਦੇ ਢੰਗ 'ਤੇ ਵੀ ਪਾਬੰਦੀਆਂ ਹੁੰਦੀਆਂ ਨੌਕਰੀ ਲਈ ਪੂਰੇ ਟਾਈਮ 'ਤੇ ਪਹੁੰਚਣਾ ਪੈਂਦਾ ਹੈ ਅਤੇ ਮਾਲਕਾਂ ਦੀ ਮਰਜ਼ੀ ਮੁਤਾਬਿਕ ਹੀ ਕੰਮ ਕਰਨਾ ਪੈਂਦਾ ਆਪਣੇ ਅਗਾਂਹ ਵਧੂ ਵਿਚਾਰਾਂ ਨੂੰ ਵੀ ਕਈ ਵਾਰੀ ਰੋਕਣਾ ਪੈਂਦਾ ਨੌਕਰੀ ਕਰਨ ਨਾਲ ਪੈਸੇ ਕਮਾਉਣ ਅਤੇ ਲੋਕਾਂ ਨੂੰ ਮਿਲਣ ਦਾ ਦਾਇਰਾ ਵੀ ਸੀਮਤ ਹੋ ਜਾਂਦਾ ਨੌਕਰੀ ਕਰਦੇ ਲੋਕਾਂ ਨੂੰ ਉੱਠਣਾ ਬੈਠਣਾ ਵੀ ਮਾਲਕਾਂ ਦੀ ਮਰਜ਼ੀ ਨਾਲ ਹੀ ਪੈਂਦਾ ਜਿਵੇਂ ਕਿ ਕਈ ਸਕੂਲਾਂ ਵਿੱਚ ਅਧਿਆਪਕ ਲਈ ਕਲਾਸ ਵਿੱਚ ਕੁਰਸੀ ਨਹੀਂ ਰੱਖੀ ਜਾਂਦੀ ਤਾਂ ਜੋ ਬੈਠ ਨਾ ਜਾਵੇ ਨੌਕਰੀ ਛੱਡਣ ਤੋਂ ਬਾਅਦ ਮੈਂ ਆਪਣੇ ਛੋਟੇ ਬੱਚਿਆਂ ਲਈ ਪਲੇਵੇ ਸਕੂਲ ਖੋਲਿਆ ਅਤੇ ਨਾਲ ਟਿਊਸ਼ਨ ਪੜ੍ਹਾਉਣੀ ਸ਼ੁਰੂ ਕੀਤੀ ਨੌਕਰੀ ਤੋਂ ਜ਼ਿਆਦਾ ਆਮਦਨ ਅਤੇ ਸਭ ਕੁਝ ਆਪਣੀ ਮਰਜ਼ੀ ਦਾ ਬੱਚਿਆਂ ਨੂੰ ਪੜ੍ਹਾਉਣ ਦੀ ਰੀਝ ਵੀ ਪੂਰੀ ਹੋਈ ਘਰ ਪਰਿਵਾਰ ਨੂੰ ਸਮਾਂ ਦੇਣ ਦਾ ਵੀ ਵਿਹਲ ਮਿਲਿਆ ਆਪਣਾ ਸਮਾਜਿਕ ਦਾਇਰਾ ਆਪਣੀ ਜਾਣ ਪਛਾਣ ਬਹੁਤ ਵਧੀ ਅਤੇ ਰੂਹਾਨੀ ਸਕੂਨ ਮਿਲਿਆ